ਅਸੀਂ ਸਾਰੇ ਇਹ ਜਾਣਦੇ ਹਾਂ ਕਿ ਬ੍ਰਹਿਮੰਡ ਦੀ ਉਤਪੱਤੀ ਇੱਕ ਬਹੁਤ ਵੱਡੇ ਧਮਾਕੇ ਤੋਂ ਹੋਈ ਜਿਸ ਨੂੰ ਕਿ ਬਿੱਗ ਬੈਂਗ ਦਾ ਨਾਮ ਦਿੱਤਾ ਗਿਆ ਅਤੇ ਇਸ ਧਮਾਕੇ ਤੋਂ ਬਾਅਦ ਹੀ ਅਰਬਾਂ ਖਰਬਾਂ ਸਿਤਾਰੇ ਜਾਂ ਗਲੈਕਸੀਆਂ ਦਾ ਜਨਮ ਹੋਇਆ ਤਾਂ ਇੱਕ ਗਲੈਕਸੀ ਜੋ ਹੁੰਦੀ ਹੈ ਉਹ ਲੱਖਾਂ ਕਰੋੜਾਂ ਤਾਰਿਆਂ ਦਾ ਇੱਕ ਸਮੂਹ ਹੁੰਦਾ ਹੈ ਉਸ ਤੋਂ ਮਿਲ ਕੇ ਬਣਦੀ ਹੈ ਅਤੇ ਸਾਇੰਟਿਸਟ ਜਾਂ ਸਾਇੰਸਦਾਨ ਇਹਨਾਂ ਗਲੈਕਸੀਆਂ ਦਾ ਅਧਿਐਨ ਇਹਨਾਂ ਦੇ ਵਿੱਚੋਂ ਨਿਕਲਣ ਵਾਲੀਆਂ ਵੇਵਲੈਂਸ ਜਾਂ ਕਿਰਨਾਂ ਉਹਨਾਂ ਦੁਆਰਾ ਕਰਦੇ ਹਨ ਜਿੱਦਾਂ ਪਾਰ ਬੈਂਗਣੀ ਕਿਰਨਾ ਜਿਨਾਂ ਨੂੰ ਅਸੀਂ ਅਲਟਰਾ ਵਾਇਲਟ ਰੈਡੀਏਸ਼ਨਜ਼ ਆਖਦੇ ਹਾਂ ਅਤੇ ਵਿਜੀਬਲ ਰੈਡੀਏਸ਼ਨਜ਼ ਤਾਂ ਇਹਨਾਂ ਰੇਡੀਏਸ਼ਨਜ਼ ਦਾ ਅਧਿਐਨ ਕਰਨ ਤੋਂ ਬਾਅਦ ਇਹ ਪਤਾ ਚੱਲਦਾ ਹੈ ਕਿ ਗਲੈਕਸੀ ਦੇ ਵਿੱਚ ਕਿੰਨੇ ਸਿਤਾਰੇ ਹਨ ਅਤੇ ਕੀ ਨਵੇਂ ਸਿਤਾਰੇ ਬਣ ਰਹੇ ਹਨ ਜਾਂ ਪੁਰਾਣੇ ਸਿਤਾਰੇ ਜੋ ਹਨ ਉਹ ਆਪਣੀ ਉਮਰ ਭੋਗ ਕੇ ਖ਼ਤਮ ਹੋ ਰਹੇ ਹਨ ਅਤੇ ਇਸ ਤਰ੍ਹਾਂ ਇਹਨਾਂ ਤਰੰਗਾਂ ਜਾਂ ਵੇਵਲੈਂਸ ਦਾ ਅਧਿਐਨ ਕਰਕੇ ਰੇਡੀਏਸ਼ਨਜ਼ ਦਾ ਅਸੀਂ ਉਸ ਗਲੈਕਸੀ ਬਾਰੇ ਬਹੁਤ ਕੁਝ ਜਾਣ ਸਕਦੇ ਹਾਂ ਇਸ ਤੋਂ ਇਲਾਵਾ ਸਾਇੰਸਦਾਨਾਂ ਨੇ ਬਹੁਤ ਸਾਰੀਆਂ ਓਬਜਰਵੇਟਰੀਜ ਅਲੱਗ ਅਲੱਗ ਥਾਵਾਂ 'ਤੇ ਬਣਾਈਆਂ ਹੋਈਆਂ ਹਨ ਜੋ ਕਿ ਲਗਾਤਾਰ ਇਸ ਚੀਜ਼ ਦਾ ਅਧਿਐਨ ਕਰਦੀਆਂ ਹਨ ਅਤੇ ਬਹੁਤ ਸਾਰੀਆਂ ਟੈਲੀਸਕੋਪਸ ਜਿੱਦਾਂ ਕਿ ਹਬਲ ਟੈਲੀਸਕੋਪ ਉਹ ਸਪੇਸ ਦੇ ਵਿੱਚ ਛੱਡੀ ਹੋਈ ਹੈ ਅਤੇ ਉਹ ਸਾਨੂੰ ਇੱਦਾਂ ਦੀਆਂ ਰੇਡੀਏਸ਼ਨ ਜਾਂ ਤਰੰਗਾਂ ਜੋ ਹਨ ਉਸ ਬਾਰੇ ਦੱਸਦੀਆਂ ਹਨ ਉਹਨਾਂ ਦਾ ਅਧਿਐਨ ਕਰਨ ਦੇ ਵਿੱਚ ਸਾਡੀ ਬਹੁਤ ਮਦਦ ਕਰਦੀਆਂ ਹਨ